ਦੋ ਦਿਸੰਬਰ ਦੋ ਹਜ਼ਾਰ ਦੋ ਅਠਾਰਾਂ ਨਵੰਬਰ ਦੋ ਹਜ਼ਾਰ ਦੋ ਅਕਤੂਬਰ ਉੱਨੀ ਸੌ ਨੜ੍ਹਿਨਵੇਂ ਪੰਦਰਾਂ ਫਰਵਰੀ ਵੀਹ ਸੌ ਉੱਨੀ ਸੋਲ੍ਹਾਂ ਜੁਲਾਈ ਉੱਨੀ ਸੌ ਇਕਹੱਤਰ ਪੰਦਰਾਂ ਜਨਵਰੀ ਉੱਨੀ ਸੌ ਬਾਨਵੇਂ